ਪੰਜਾਬ ਸਰਕਾਰ ਦੂਜੇ ਪੱਧਰਾਂ ਨਾਲ ਬਹੁਤ ਵਧੀਆ ਕੰਮ ਕਰਦੀ ਹੈ ਜਿਵੇਂ ਕਿ ਸਰਕਾਰੀ ਇਮਾਰਤਾਂ ਦੇ ਪੈਸੇ ਇਕੱਠੇ ਕਰਨਾ ਟੂਲ ਪਲਾਜੇ ਪੈਸੇ ਇਕੱਠੇ ਕਰਨਾ ਅਤੇ ਹੋਰ ਵੀ ਸਾਰੇ ਅਜਿਹੇ ਕੰਮ ਹਨ ਜਿੱਥੇ ਸਰਕਾਰਾਂ ਨੂੰ ਬਹੁਤ ਚੰਗਾ ਚੰਗਾ ਕਰਨ 'ਤੇ ਪੈਸੇ ਇਕੱਠੇ ਹੁੰਦੇ ਹਨ ਸਰਕਾਰ ਨੂੰ ਚੰਗਾ ਤਾਂ ਹੀ ਮੰਨਿਆ ਜਾਂਦਾ ਹੈ ਕਿ ਉਸਦੀ ਦੀ ਸਹਾਇਤਾ ਦੇ ਨਾਲ ਲੋਕਾਂ ਦੇ ਕੰਮ ਖੁਸ਼ ਹੋਣ ਪੰਜਾਬ ਸਰਕਾਰ ਹੋਣ ਵਾਲੀ ਤਾਂ ਬਹੁਤ ਚੰਗਾ ਕੰਮ ਕਰਦੀ ਹੈ ਭਾਵੇਂ ਥੋੜ੍ਹਾ ਟਾਈਮ ਲੱਗਦਾ ਹੈ ਪਰ ਕੰਮ ਬਹੁਤ ਵਧੀਆ ਹੁੰਦਾ ਹੈ ਤਾਂ ਹੀ ਤਾਂ ਸਰਕਾਰ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ ਅਤੇ ਹਰੇਕ ਕੰਮ ਵਿੱਚ ਸਹਾਇਤਾ ਕਰਦੀ ਹੈ ਹਰੇਕ ਥਾਂ ਹਰੇਕ ਘੜੀ ਪਲ ਖੜ੍ਹਦੀ ਹੈ ਅਤੇ ਬਸ ਇਹ ਇਹਦੇ ਵਿੱਚ ਬਹੁਤ ਵਧੀਆ ਕੰਮ ਹੁੰਦਾ